ਭੰਗੜੇ ਦੇ ਕੁਛ ਆਮ ਸਟੈਪ ਹਾਥੀ ਚਾਲ ਫੁੱਲ ਪੰਜਾਬ ਤਾੜੀ ਝੁੰਮਰ ਫੁੰਮਣੀਆਂ ਬੇਦੀ ਧਮਾਲ ਮੱਖਣੇ ਡੰਕਰਾ ਅਤੇ ਤਾੜੀ ਪੰਜਾਬ ਹਨ ਭੰਗੜਾ ਪੰਜਾਬ ਦਾ ਲੋਕ ਨਾਚ ਵੀ ਮੰਨਿਆ ਜਾਂਦਾ ਹੈ ਲੋਕ ਭੰਗੜੇ ਨੂੰ ਤਾਂ ਵਿਸਾਖੀ 'ਤੇ ਵੀ ਪਾਉਂਦੇ ਹਨ ਭੰਗੜਾ ਅੱਜ ਕੱਲ੍ਹ ਇੱਕ ਛੋਟਾ ਬੱਚਾ ਜਵਾਨ ਅਤੇ ਬੁੱਢਾ ਬੰਦਾ ਵੀ ਪਾਉਂਦਾ ਹੈ ਲੋਕ ਭੰਗੜੇ ਨੂੰ ਕਰਨ ਪਾਉਣ ਨਾਲ ਤੰਦਰੁਸਤ ਅਤੇ ਤਕੜੇ ਵੀ ਰਹਿੰਦੇ ਹਨ ਭੰਗੜਾ ਪਾਉਣ ਨਾਲ ਤਾਂ ਅੱਜ ਕੱਲ੍ਹ ਕਈ ਸਾਰੀਆਂ ਬਿਮਾਰੀਆਂ ਵੀ ਦੂਰ ਹੁੰਦੀਆਂ ਹਨ ਲੋਕ ਅੱਜ ਕੱਲ੍ਹ ਤਾਂ ਭੰਗੜੇ ਨੂੰ ਸਿੱਖਣ ਲਈ ਭੰਗੜੇ ਸਕੂਲਾਂ ਵਿੱਚ ਵੀ ਭਰਤੀ ਹੁੰਦੇ ਹਨ ਜਿਸ ਦੀ ਫੀਸ ਲੋਕ ਪੰਦਰ੍ਹਾਂ ਸੌ ਤੋਂ ਲੈ ਕੇ ਦੋ ਹਜ਼ਾਰ ਤੱਕ ਭਰਦੇ ਹਨ ਲੋਕ ਭੰਗੜੇ ਨੂੰ ਬੜੇ ਹੀ ਚਾਅ ਉਤਸ਼ਾਹ ਜੋਰਾਂ ਸ਼ੋਰਾਂ ਨਾਲ ਪਾਉਂਦੇ ਹਨ ਲੋਕ ਜਿਸ ਨੂੰ ਸਮਝਦੇ ਹਨ ਕਿ ਭੰਗੜਾ ਕਰਨ ਨਾਲ ਉਹਨਾਂ ਦੀਆਂ ਸਭ ਬਿਮਾਰੀਆਂ ਦੂਰ ਹੁੰਦੀਆਂ ਹਨ